ਸਟੇਟ ਵਿੱਚ ਜਿੰਨੀਆਂ ਵੀ ਭਾਸ਼ਾ ਬੋਲੀਆਂ ਜਾਂਦੀਆਂ ਹਨ ਉਹ ਭਾਰਤ ਦੀਆਂ ਸਰਕਾਰੀ ਭਾਸ਼ਾਵਾਂ ਹਨ ਹਿੰਦੀ ਭਾਰਤ ਦੀ ਸਰਕਾਰੀ ਭਾਸ਼ਾ ਹੈ ਇੱਥੇ ਇੰਗਲਿਸ਼ ਵੀ ਬਹੁਤ ਚੱਲ ਰਹੀ ਹੈ ਇਹ ਇੰਟਰਨੈਸ਼ਨਲ ਭਾਸ਼ਾ ਹੋਣ ਕਰਕੇ ਇਸਨੂੰ ਸਰਕਾਰੀ ਭਾਸ਼ਾ ਦੀ ਮਾਨਤਾ ਦਿੱਤੀ ਗਈ ਹੈ ਕਿਉਂਕਿ ਭਾਰਤ ਦਾ ਹਰ ਵਿਅਕਤੀ ਜੋ ਪੜ੍ਹਿਆ ਲਿਖਿਆ ਹੈ ਕਿਸੇ ਵੀ ਰਾਜ ਨਾਲ ਕਿਸੇ ਵੀ ਭਾਸ਼ਾ ਨਾਲ ਸੰਬੰਧ ਰੱਖਦਾ ਹੋਵੇ ਉਹ ਅੰਗਰੇਜ਼ੀ ਭਾਸ਼ਾ ਨੂੰ ਸਮਝ ਸਕਦਾ ਹੈ ਅੰਗਰੇਜ਼ੀ ਭਾਸ਼ਾ ਦਫਤਰ ਵਿੱਚ ਵੀ ਕੰਮ ਕਾਜ ਲਈ ਵਰਤੀ ਜਾਂਦੀ ਹੈ ਭਾਰਤ ਵਿੱਚ ਕੁੱਲ ਬਾਈ ਭਾਸ਼ਾਵਾਂ ਹਨ ਜਿਵੇਂ ਤੈਲਗੂ ਮਲਿਆਲਮ ਕੰਨੜ ਮਰਾਠੀ ਉੜੀਆ ਹਿੰਦੀ ਮਨੀਪੁਰ ਕਸ਼ਮੀਰੀ ਨੇਪਾਲੀ ਪੰਜਾਬੀ ਸੰਸਕ੍ਰਿਤੀ ਉਰਦੂ ਗੁਜਰਾਤੀ ਆਦਿ ਦੇਸ਼ ਦੀ ਭਾਸ਼ਾਈ ਵਿਭਿੰਨਤਾ ਇਹ ਹੈ ਕਿ ਇਕ ਰਾਜ ਦੂਜੇ ਰਾਜ ਦੀ ਭਾਸ਼ਾ ਨਹੀਂ ਸਮਝਦਾ ਜਿਵੇਂ ਪੰਜਾਬੀ ਬੋਲਣ ਵਾਲੇ ਦੇ ਸਾਹਮਣੇ ਕੰਨੜ ਦਾ ਕੋਈ ਵਿਅਕਤੀ ਬੈਠਾ ਹੋਵੇਗਾ ਉਸਨੂੰ ਪੰਜਾਬੀ ਸਮਝ ਨਹੀਂ ਆਵੇਗੀ ਜਿਵੇਂ ਮਲਿਆਲਮ ਵੀ ਮਲਿਆਲਮ ਵਿੱਚ ਰਹਿਣ ਵਾਲੇ ਨੂੰ ਵੀ ਸਮਝ ਆਉਂਦੀ ਹੈ ਜਾਂ ਜਿਸ ਨੇ ਉੱਥੇ ਰਹਿ ਕੇ ਭਾਸ਼ਾ ਸਿੱਖੀ ਹੋਏਗੀ ਉਹ ਵਿਅਕਤੀ ਇਸ ਭਾਸ਼ਾ ਨੂੰ ਸਮਝ ਸਕਦਾ ਹੈ ਹਰ ਰਾਜ ਦੀ ਆਪਣੀ ਭਾਸ਼ਾ ਹੈ ਇਸ ਕਰਕੇ ਹਰ ਰਾਜ ਵਿੱਚ ਭਾਸ਼ਾਈ ਵਿਭਿੰਨਤਾ ਹੈ